ਇੱਕ ਚੰਗੀ ਫੋਟੋ ਖਿੱਚਣ ਲਈ ਅਸੀਂ ਬਹੁਤ ਸਾਰੀਆਂ ਪ੍ਰਕਿਰਿਆ ਦਾ ਪਾਲਣ ਕਰਦੇ ਹਾਂ ਜਿਵੇਂ ਕਿ ਸਨੈਪਚੈਟ ਸਨੈਪਚੈਟ ਉੱਪਰ ਦੇਖਿਆ ਜਾਵੇ ਜਦੋਂ ਅਸੀਂ ਆਪਣੀ ਫੋਟੋ ਖਿੱਚਾਂਗੇ ਤਾਂ ਅਸੀਂ ਉਸ ਉਸ ਉੱਤੇ ਕਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਿਲਟਰ ਲਗਾ ਸਕਦੇ ਹਾਂ ਜੇ ਜਿਹਦੇ ਨਾਲ ਸਾਡੀ ਫੋਟੋ ਵਧੀਆ ਆ ਸਕੇ ਅਤੇ ਜਦੋਂ ਜਿਵੇਂ ਅਸੀਂ ਫੋਟੋ ਉੱਪਰ ਕੋਈ ਵੀ ਇਮੋਜੀ ਲਾਉਣਾ ਹੋਵੇ ਤਾਂ ਅਸੀਂ ਸਨੈਪਚੈਟ ਉਸ ਤੋਂ ਫੋਟੋ ਉੱਪਰ ਕੋਈ ਵੀ ਇਮੋਜੀ ਦਾ ਲਗਾ ਸਕਦੇ ਹਾਂ ਕੈਮਰਾ ਕੈਮਰਾ ਫੋਨ ਦਾ ਕੈਮਰਾ ਕੈਮਰੇ ਵਿੱਚ ਦੇਖਿਆ ਜਾਵੇ ਤਾਂ ਸਾਡੀ ਫੋਟ ਜਿੱਦਾਂ ਦਾ ਸਾਡਾ ਫੇਸ ਸਾਡੀ ਫੋਟੋ ਉਦਾਂ ਦੀ ਆਏਗੀ ਕੈਮਰੇ ਵਿੱਚ ਅਤੇ ਸਨੈਪਚੈਟ ਵਿੱਚ ਅਸੀਂ ਕੋਈ ਵੀ ਅਤੇ ਕਿਸੇ ਵੀ ਤਰ੍ਹਾਂ ਦਾ ਫਿਲਟ ਲਾ ਸਕਦੇ ਹਾਂ ਜਿਸ ਨਾਲ ਸਾਡੀ ਫੋਟੋ ਵਧੀਆ ਬਣ ਸਕੇ ਅਤੇ ਸਾਫ਼ ਅਤੇ ਸੁੰਦਰ ਦਿਖ ਸਕਦੀ ਆ ਅਤੇ ਫੋਟੋ ਖਿਚ ਫੋਟੋ ਨਾਲ ਅਸ ਅਤੇ ਸਨੈਪਚੈਟ ਅਸ ਉੱਤੇ ਕੋਈ ਵੀ ਵੀਡੀਓ ਵੀ ਬਣਾ ਸਕਦੇ ਹਾਂ ਉੱਥੇ ਸੋਹਣੀ ਵੀ ਬਣਾ ਸਕਦੇ ਹਾਂ ਅਤੇ ਫੋਟੋ ਉੱਪਰ ਉਸ ਤ ਕੋਈ ਕਿਸੇ ਵੀ ਤਰ੍ਹਾਂ ਦਾ ਇਮੋਜੀ ਜਾਂ ਕੋਈ ਇਫੈਕਟ ਲਾ ਸਕਦੇ ਹਾਂ ਫੋਟੋ ਨੂੰ ਸੁੰਦਰ ਬਣਾਉਣ ਲਈ ਅਸੀਂ ਸਨੈਪਚੈਟ ਦੀ ਮਦਦ ਕਰ ਮਦਦ ਲੈ ਸਕਦੇ ਹਾਂ ਅਤੇ ਕੋਈ ਵੀ ਫਿਲਟਰ ਲਾ ਸਕਦੇ ਹਾਂ ਫਿਲਟਰ ਨਾਲ ਸਾਡੀ ਫੋਟੋ ਵਧੀਆ ਅਤੇ ਸੁੰਦਰ ਬਣ ਜਾਵੇਗੀ ਅਤੇ ਅਸੀਂ ਉਸ ਫੋਟੋ ਵਿੱਚ ਹੋਰ ਵੀ ਸੁੰਦਰ ਦਿਖ ਸਕਦੇ ਹਾਂ ਇਸ ਲਈ ਅਸੀਂ ਫੋਟੋ ਖਿੱਚਣ ਲਈ ਅਸੀਂ ਸਨੈਪਚੈਟ ਦੀ ਵਰਤੋਂ ਕਰਦੇ ਹਾਂ ਇਸ ਲਈ ਸਨੈਪਚੈਟ ਬਹੁਤ ਹੀ ਵਧੀਆ ਹੈ ਵਧੀਆ ਐਪ ਬਣਾਇਆ ਗਿਆ ਹੈ ਤਾਂ ਜੋ ਕਿ ਉਹ ਫੋਟੋ ਸੁੰਦਰ ਬਣਾਉਂਦਾ ਹੈ